ਮੋਹਾਲੀ ਜ਼ਿਲ੍ਹੇ ਵਿੱਚ ਅਕਸਰ ਮੌਸਮ ਬਹੁਤ ਵਧੀਆ ਰਹਿੰਦਾ ਹੈ ਪਰ ਜੇ ਮੈਂ ਗੱਲ ਕਰਾਂ ਜੂਨ ਤੋਂ ਜੁਲਾਈ ਮਹੀਨੇ ਦੇ ਵਿੱਚ ਇੱਥੇ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤ ਜਿਆਦਾ ਲੋਕਾਂ ਦੀਆਂ ਸਿਹਤਾਂ ਉੱਤੇ ਇਸਦਾ ਬੁਰਾ ਅਸਰ ਪੈਂਦਾ ਹੈ ਮੋਹਾਲੀ ਜੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਸਭ ਤੋਂ ਵਧੀਆ ਮੌਸਮ ਸਤੰਬਰ ਤੋਂ ਦਸੰਬਰ ਤੱਕ ਦਾ ਰਹਿੰਦਾ ਹੈ ਇਸ ਸਮੇਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਅਤੇ ਨਾ ਜ਼ਿਆਦਾ ਠੰਡਾ ਅਤੇ ਨਾ ਜ਼ਿਆਦਾ ਗਰਮ ਮੌਸਮ ਰਹਿੰਦਾ ਹੈ ਜਿਸ ਦਾ ਲੋਕ ਬਹੁਤ ਆਨੰਦ ਮਾਣਦੇ ਹਨ ਅਤੇ ਇਸ ਤੋਂ ਇਲਾਵਾ ਇਹ ਮੌਸਮ ਵਿੱਚ ਲੋਕ ਬਹੁਤ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੀ ਸਿਹਤ ਉੱਤੇ ਇਸਦਾ ਕੋਈ ਪ੍ਰਭਾਵ ਨਹੀਂ ਪੈਂਦਾ